ਇੱਕ ਚੰਗੇ ਬੈਂਕ ਵਜੋਂ ਆਪਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਬੈਂਕ ਦੇ ਖਰਚੇ ਘੱਟ ਹੋਣ ਅਤੇ ਉਸ ਬੈਂਕ ਦੀਆਂ ਕੈਪੀਟਲ ਅਤੇ ਬਰਾਂਚਾਂ ਬਹੁਤ ਜ਼ਿਆਦਾ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਉਸ ਬੈਂਕ ਦੇ ਡੋਬਣ ਦਾ ਖਤਰਾ ਘੱਟ ਹੋਵੇ ਅਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇੱਕ ਸਰਕਾਰੀ ਬੈਂਕ ਹੀ ਚੋਣ ਕਰੀਏ